ਹਾਂਜੀ ਹੈਲੋ ਕੀ ਤੁਸੀਂ ਮੇਰਾ ਭੋਜਨ ਲੈ ਕੇ ਨਿਕਲ ਚੁੱਕੇ ਹੋ ਠੀਕ ਹੈ ਅਤੇ ਮੇਰੇ ਤੱਕ ਕਿੰਨੀ ਦੇਰ 'ਚ ਪਹੁੰਚੋਗੇ ਦਸ ਮਿੰਟ 'ਚ ਇੰਨੀ ਦੇਰ 'ਚ ਤਾਂ ਮੇਰਾ ਖਾਣਾ ਠੰਡਾ ਹੋ ਜਾਣਾ ਤੁਸੀਂ ਇਸ ਤੋਂ ਪਹਿਲਾਂ ਨਿਕਲਣਾ ਚਾਹੀਦਾ ਸੀ ਹੁਣ ਤੁਹਾਨੂੰ ਮੇਰਾ ਘਰ ਕਿੱਦਾਂ ਲੱਭੇਗਾ ਉਹਨਾਂ ਨੇ ਮੇਰਾ ਪੂਰਾ ਐਡਰੈੱਸ ਤੁਹਾਨੂੰ ਦਿੱਤਾ ਹੈ ਠੀਕ ਹੈ ਤੁਸੀਂ ਇਸ ਤਰ੍ਹਾਂ ਕਰੋ ਜੇਕਰ ਮੇਰਾ ਘਰ ਲੱਭਣ ਵਿੱਚ ਤਕਲੀਫ਼ ਹੋ ਰਹੀ ਹੈ ਤਾਂ ਤੁਸੀਂ ਮੇਰੇ ਨਾਲ ਫ਼ੋਨ 'ਤੇ ਗੱਲ ਕਰਦੇ ਜਾਉ ਤਾਂ ਕਿ ਮੈਂ ਤੁਹਾਨੂੰ ਆਪਣੇ ਘਰ ਦੀ ਸਹੀ ਐਡਰੈੱਸ ਦੱਸ ਸਕਾਂ ਠੀਕ ਹੈ ਜੀ ਸੋ ਤੁਸੀਂ ਚੱਲਦੇ ਰਹੋ ਹੁਣ ਤੁਸੀਂ ਕਿੱਥੇ ਪਹੁੰਚੇ ਹੋ ਠੀਕ ਹੈ ਤੁਸੀਂ ਇੱਥੋਂ ਖੱਬੇ ਮੁੜੋ ਠੀਕ ਹੈ ਅੱਗੇ ਚੱਲਦੇ ਜਾਉ ਇਸ ਤੋਂ ਅੱਗੇ ਸੱਜੇ ਮੁੜੋ ਚੱਲਦੇ ਜਾਉ ਇਸ ਤੋਂ ਅੱਗੇ ਇੱਕ ਦੁਕਾਨ ਹੈ ਉਸ ਤੋਂ ਅੱਗੇ ਚੱਲਦੇ ਜਾਉ ਉਸ ਦੁਕਾਨ ਤੋਂ ਅੱਗੇ ਆ ਜਾਉ ਇੱਕ ਚੌਂਕ ਆਵੇਗਾ ਉਸ ਚੌਂਕ ਤੋਂ ਸੱਜੇ ਪਾਸੇ ਮੁੜ ਜਾਉ ਇੱਕ ਮੰਦਰ ਦਿਖੇਗਾ ਉਸ ਮੰਦਰ ਦੇ ਨਾਲ਼ ਬਿਲਕੁਲ ਇੱਕ ਹੋਰ ਦੁਕਾਨ ਹੈ ਤੁਸੀਂ ਉਸ ਦੁਕਾਨ ਵਾਲੇ ਨੂੰ ਪੁੱਛੋ ਉਹ ਤੁਹਾਨੂੰ ਦੱਸੇਗਾ ਹਾਂਜੀ ਉਸ ਨੇ ਤੁਹਾਨੂੰ ਦੱਸ ਦਿੱਤਾ ਹੈ ਕਿ ਇਸ ਤੋਂ ਅਗਲੇ ਮੰਦਰ ਦੇ ਸਾਹਮਣੇ ਮੇਰਾ ਘਰ ਹੈ ਠੀਕ ਹੈ ਤੁਸੀਂ ਜਦੋਂ ਆਵੋਗੇ ਬੈੱਲ ਮਾਰ ਦੇਣਾ ਜਾਂ ਇਸ ਤਰ੍ਹਾਂ ਕਰਦਾ ਹਾਂ ਕਿ ਮੈਂ ਬਾਹਰ ਖੜ੍ਹ ਜਾਂਦਾ ਹਾਂ ਤੁਸੀਂ ਬਾਹਰ ਮੇਰੀ ਉਡੀਕ ਕਰੋ ਠੀਕ ਹੈ